ਜ਼ਿੰਦਗੀ ਦੀ ਦੌੜ ਹਮੇਸ਼ਾ ਹੀ ਚਲਦੀ ਰਹਿੰਦੀ ਹੈ ਪਰ ਆਪਾਂ ਅੱਜ ਗੱਲ ਕਰਦੇ ਹਾਂ ਫਿਜ਼ੀਕਲ ਦੌੜ ਦੀ ਫਿਜ਼ੀਕਲ ਦੌੜ ਸਿਹਤ ਨੂੰ ਬਹੁਤ ਹੀ ਤੰਦਰੁਸਤ ਬਣਾਈ ਰੱਖਦੀ ਹੈ ਅੱਜ ਦੇ ਜ਼ਮਾਨੇ 'ਚ ਫਿਜ਼ੀਕਲ ਦੌੜ ਬਹੁਤ ਹੀ ਚੰਗੀ ਹੈ ਜੇ ਆਪਾਂ ਭੱਜਦੇ ਹਾਂ ਤਾਂ ਆਪਣਾ ਸਰੀਰ ਠੀਕ ਰਹਿੰਦਾ ਤੰਦਰੁਸਤ ਰਹਿੰਦਾ ਡੋਕਟਰ ਕਹਿੰਦੇ ਨੇ ਕਿ ਵੀ ਆਪਾਂ ਨੂੰ ਭੱਜਣਾ ਚਾਹੀਦਾ ਗਾ ਪਰ ਭੱਜਣ ਦੇ ਵੀ ਦੋ ਟਾਈਮ ਨੇਗੇ ਦੋ ਸਮੇਂ ਨੇਗੇ ਇੱਕ ਆਪਾਂ ਸਵੇਰੇ ਭੱਜਣ ਜਾ ਸਕਦੇ ਹਾਂ ਜਲਦੀ ਉੱਠ ਕੇ ਦੂਜਾ ਸ਼ਾਮ ਨੂੰ ਪਰ ਜ਼ਿਆਦਾਤਰ ਇਹ ਪ੍ਰੈਫਰ ਕੀਤਾ ਜਾਂਦਾ ਹੈਗਾ ਕਿ ਜਦੋਂ ਆਪਾਂ ਸੁਬਹਾ ਜਲਦੀ ਉੱਠ ਕੇ ਰਨਿੰਗ ਕਰਦੇ ਹਾਂ ਭੱਜਣ ਜਾਂਦੇ ਹਾਂ ਉਸ ਨਾਲ ਆਪਣਾ ਸਰੀਰ ਤੰਦਰੁਸਤ ਰਹਿੰਦਾ ਹੈ ਮਾਸਪੇਸ਼ੀਆਂ ਵਧੀਆ ਰਹਿੰਦੀਆਂ ਨੇ ਦਿਮਾਗ ਵਧੀਆ ਖੁੱਲ੍ਹਦਾ ਹੈ ਚੱਲਦਾ ਹੈਗਾ ਅਤੇ ਅੱਜ ਇੱਕ ਹੋਰ ਭੱਜਣ ਦੇ ਨਾਲ ਆਪਾਂ ਇੱਕ ਹੋਰ ਚੀਜ਼ ਐਡ ਕਰਨ ਲੱਗ ਗਏ ਹਾਂ ਉਹ ਹੈਗੇ ਗਾ ਸਮਾਰਟ ਫੋਨ ਦੀ ਅਤੇ ਹੈਡਫੋਨਸ ਦੀ ਮਦਦ ਦੇ ਨਾਲ ਮਿਊਜ਼ਿਕ ਸੁਣਨਾ ਪੋਡਕਾਸਟ ਸੁਣਨੇ ਜਦੋਂ ਵੀ ਮੈਂ ਭੱਜਣ ਜਾਂਦੀ ਹਾਂ ਤਾਂ ਮੈਂ ਹੈਡਫੋਨ ਲਾ ਕੇ ਮਿਊਜ਼ਿਕ ਸੁਣਦੀ ਹਾਂ ਮਿਊਜ਼ਿਕ ਸੁਣ ਕੇ ਭੱਜਣ 'ਚ ਮੈਨੂੰ ਹੋਰ ਵੀ ਮਜ਼ਾ ਆਉਂਦਾ ਗਾ ਜਦੋਂ ਮੈਂ ਮਿਊਜ਼ਿਕ ਸੁਣਦੀ ਸੁਣਦੀ ਭੱਜਦੀ ਹਾਂ ਤਾਂ ਇਸ ਨਾਲ ਮੈਨੂੰ ਬਿਲਕੁਲ ਥਕਾਵਟ ਮਹਿਸੂਸ ਨਹੀਂ ਹੁੰਦੀ ਫੇਰ ਟਾਈਮ ਟੂ ਟਾਈਮ ਮੈਂ ਆਪ ਦਾ ਟੇਸਟ ਵੀ ਚੇਂਜ ਕਰਦੀ ਹਾਂ ਜਿਵੇਂ ਕਦੇ ਮੈਂ ਮਿਊਜ਼ਿਕ ਸੁਣਦੀ ਹਾਂ ਕਦੇ ਮੈਂ ਅਲੱਗ ਅਲੱਗ ਪੋਡਕਾਸਟ ਸੁਣਦੀ ਹਾਂ ਕਦੇ ਮੈਂ ਮੋਟੀਵੇਸ਼ਨਲ ਵੀਡੀਓਜ਼ ਦੇਖਦੀ ਹਾਂ ਜਿਵੇਂ ਹਿਤੇਸ਼ ਸਰ ਦੀਆਂ ਹੋ ਗਈਆਂ ਹਿਮਾਂਸ਼ੂ ਸਰ ਦੀਆਂ ਹੋ ਗਈਆਂ ਠੀਕ ਹੈ ਭੱਜਣ ਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਫਰਕ ਪਿਆ ਗਾ ਪਹਿਲਾਂ ਮੈਂ ਇੰਨਾਂ ਜ਼ਿਆਦਾ ਕੋਨਸਟਰੇਸ਼ਨ ਨਹੀਂ ਕਰ ਪਾਉਂਦੀ ਸੀ ਪਰ ਭੱਜਣ ਦੀ ਮਦਦ ਨਾਲ ਮੇਰਾ ਕੋਨਸਟਰੇਸ਼ਨ ਲੈਵਲ ਵਧੇਗਾ ਫੋਕਸ ਲੈਵਲ ਵਧੇਗਾ ਮੇਰੀਆਂ ਮਾਸਪੇਸ਼ੀਆਂ ਮਜ਼ਬੂਤ ਹੋਈਆਂ ਨੇ ਅਤੇ ਹੁਣ ਮੈਨੂੰ ਭੱਜਣ 'ਚ ਬਹੁਤ ਹੀ ਜ਼ਿਆਦਾ ਆਨੰਦ ਮਿਲਦਾ ਹੈਗਾ ਹੁਣ ਮੈਂ ਆਪਣੇ ਆਪ ਸੁਬਹਾ ਹੀ ਜਲਦੀ ਉੱਠ ਕੇ ਭੱਜਣ ਲਈ ਜਾਂਦੀ ਹਾਂ ਭੱਜਦੇ ਭੱਜਦੇ ਪਤਾ ਹੀ ਨਹੀਂ ਲੱਗਦਾ ਜਦੋਂ ਆਪਾਂ ਭੱਜਦੇ ਭੱਜਦੇ ਹੈਡਫੋਨ ਲਾ ਲੈਂਦੇ ਹਾਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਟਾਈਮ ਮੈਨੇ ਰਨਿੰਗ ਕੀਤੀ ਹੈ ਕਈ ਵਾਰ ਰਨਿੰਗ ਕਰਦੇ ਕਰਦੇ ਮੈਨੂੰ ਦੋ ਤਿੰਨ ਘੰਟੇ ਵੀ ਲੱਗ ਜਾਂਦੇ ਨੇ ਪਰ ਫੇਰ ਵੀ ਸਰੀਰ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਕਿਉਂਕਿ ਕਦੇ ਕਦੇ ਅਲੱਗ ਅਲੱਗ ਪੋਡਕਾਸਟਸ ਸੁਣਨ ਨਾਲ ਮੈਨੂੰ ਪਤਾ ਹੀ ਨਹੀਂ ਚੱਲਦਾ ਕਿ ਵੀ ਮੈਂ ਕਿੰਨਾ ਟਾਈਮ ਭੱਜ ਰਹੀ ਹਾਂ ਕਦੇ ਕਦੇ ਮੋਟੀਵੇਸ਼ਨ ਸੁਣਦੇ ਸੁਣਦੇ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਟਾਈਮ ਹੋ ਗਿਆ ਮੈਨੂੰ ਮੋਟੀਵੇਸ਼ਨ ਸੁਣਦੇ ਸੁਣਦੇ ਇਸੇ ਤਰੀਕੇ ਨਾਲ ਮੈਨੂੰ ਰਨਿੰਗ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ